ਹਾਂਜੀ ਸਾਨੂੰ ਪਾਣੀ ਦੀ ਸਪਲਾਈ ਮਿਲਦੀ ਹੈ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਪਾਣੀ ਜਿਹੜਾ ਸੀਗਾ ਉਹ ਨਦੀਆਂ ਤੋਂ ਆਪਾਂ ਲੈਂਦੇ ਹੁੰਦੇ ਸੀਗੇ ਸਾਰੇ ਕੰਮ ਉਥੋਂ ਮਤਲਬ ਪਾਣੀ ਲੈ ਕੇ ਘਰ ਦੇ ਵਿੱਚ ਲਿਆਉਣਾ ਅਤੇ ਬਹੁਤ ਸਾਰਾ ਟਾਈਮ ਜਿਹੜਾ ਸੀ ਉਹ ਲੱਗ ਜਾਂਦਾ ਸੀ ਘਰ ਦੀ ਆਮ ਲੇਡੀਜ ਨੂੰ ਬਹੁਤ ਪ੍ਰੋਬਲਮ ਆਉਂਦੀ ਹੁੰਦੀ ਸੀ ਹੁਣ ਸਾਰਾ ਟੂਟੀ ਦਾ ਜਿਹੜਾ ਪਾਣੀ ਹੈ ਇਹ ਘਰਾਂ ਦੇ ਵਿੱਚ ਆਉਂਦਾ ਅਤੇ ਜਲਦੀ ਤੋਂ ਜਲਦੀ ਜਿਹੜਾ ਸਾਡਾ ਕੰਮ ਹੈ ਟੂਟੀ ਦੇ ਪਾਣੀ ਦੇ ਨਾਲ ਜਲਦੀ ਤੋਂ ਜਲਦੀ ਹੋ ਜਾਂਦਾ ਅਤੇ ਆਪਣਾ ਜਿਹੜਾ ਜੀਵਨ ਹੈ ਹੁਣ ਕਾਫੀ ਚੇਂਜ ਹੋ ਗਿਆ ਲਾਈਫ ਕਾਫੀ ਚੇਂਜ ਹੋ ਗਈ ਹੈ ਇਸ ਤਰ੍ਹਾਂ ਲਾਈਫ ਚੇਂਜ ਹੋਣ ਦੇ ਨਾਲ ਪਹਿਲਾਂ ਜਿਹੜਾ ਸਮਾਂ ਸੀਗਾ ਉਹ ਬਹੁਤ ਸਾਰਾ ਪਾਣੀ ਦੇ ਵਿੱਚ ਹੀ ਲੱਗ ਜਾਂਦਾ ਸੀਗਾ ਦੂਰ ਤੋਂ ਲਿਆਉਣਾ ਕਰਨਾ ਕੰਮ ਹੁਣ ਕੀ ਹੈ ਹੁਣ ਘਰ ਟਾਈਮ ਦੇ ਅਨੁਸਾਰ ਪਾਣੀ ਜਿਹੜਾ ਆ ਜਾਂਦਾ ਅਤੇ ਸਾਰੇ ਕੰਮ ਵੱਖਰੇ ਵੱਖਰੇ ਟਾਈਮ 'ਤੇ ਸਹੀ ਤਰੀਕੇ ਦੇ ਨਾਲ ਹੋ ਜਾਂਦੇ ਆ ਕਿ ਪਾਣੀ ਸਾਫ ਹੈ ਪਾਣੀ ਸਾਫ ਬਾਰੇ ਆਪਾਂ ਕਹਾਂਗੇ ਕਿ ਪਾਣੀ ਜਿਹੜਾ ਪਹਿਲਾਂ ਵਾਲਾ ਨਦੀਆਂ ਵਾਲਾ ਸੀਗਾ ਉਹ ਮਤਲਬ ਕਿ ਕਾਫੀ ਹੁੰਦਾ ਸੀ ਸਾਫ ਹੁਣ ਜਿਹੜਾ ਪਾਣੀ ਕਾਰਪੋਰੇਸ਼ਨ ਦੇ ਵਿੱਚੋਂ ਆਉਂਦਾ ਹੈ ਏਰੀਏ ਦੇ ਵਿੱਚੋਂ ਅਤੇ ਉਹ ਪਾਣੀ ਦੇ ਵਿੱਚ ਥੋੜ੍ਹੀ ਥੋੜ੍ਹੀ ਮਤਲਬ ਪ੍ਰੋਬਲਮ ਆ ਰਹੀ ਹੈ